ਹੈਲੋ ਹਾਂਜੀ ਹਾਂਜੀ ਹਾਂਜੀ

ਕਿੱਥੋਂ ਕਿੱਥੋਂ ਬੋਲ ਰਹੇ ਤੁਸੀਂ ਅੱਛਾ ਅੱਛਾ ਠੀਕ ਹੈ ਠੀਕ ਹੈ ਐਚੁਲੀ ਪਤਾ ਕੀ ਹੈ ਮੈਂ ਥੋੜ੍ਹਾ ਜਿਹਾ ਬਾਹਰ ਸੀਗਾ ਮੈਨੂੰ ਥੋੜ੍ਹੇ ਦੋ ਘੰਟੇ ਲੱਗ ਜਾਣਗੇ ਅਤੇ ਤੁਸੀਂ ਇੰਨੇ ਦੇਖੋ ਵੀ ਕਿ ਸ਼ੁਅ ਵਗੈਰਾ ਕੀ ਹੋਇਆ ਤੁਹਾਡਾ ਜੀ ਫਿਊਜ਼ ਵਗੈਰ ਉੱਡਿਆ ਕੋਈ ਇਹ ਕਿ ਅੱਛਾ ਪਲੱਗ ਥੋੜ੍ਹਾ ਤਾਰ ਤੁਰ ਹਿਲਾ ਕੇ ਦੇਖ ਲਓ ਕੋਈ ਕਿਸੇ ਤਰ੍ਹਾਂ ਦਾ ਕੋਈ ਮਾੜਾ ਮੋਟਾ ਚੱਲ ਪਵੇ ਜੀ ਜੇ ਕੋਈ ਐਚੁਲੀ ਹਾਂਜੀ ਪਤਾ ਕੀ ਹੈ ਮੈਂ ਮੈਂ ਥੋੜ੍ਹਾ ਜਿਹਾ ਮੈਂ ਥੋੜ੍ਹਾ ਜਿਹਾ ਬਾਹਰ ਸੀਗਾ ਮੈਂ ਨਾ ਇੱਧਰੋਂ ਥੋੜ੍ਹਾ ਕੰਮ ਛਿੜਿਆ ਹੋਇਆ ਸੀਗਾ ਇਹਨਾਂ ਦਾ ਵੀ ਕੰਮ ਕਾਫੀ ਪੈਂਡਿੰਗ ਸੀਗਾ ਅਤੇ ਅੱਜ ਮੈਂ ਇਹਨਾਂ ਦਾ ਕੰਮ ਨਿਬੇੜ ਕੇ ਆਉਣਾ ਸੀ ਮੈਨੂੰ ਦੋ ਘੰਟੇ ਲੱਗ ਜਾਣਗੇ ਜਾਂ ਦੋ ਘੰਟੇ ਤੁਸੀਂ ਵੇਟ ਕਰ ਲਓ ਥੋੜ੍ਹੀ ਜੀ ਅੱਛਾ ਅੱਛਾ ਕੋਈ ਗੱਲ ਫਿਰ ਮੈਂ ਥੋੜ੍ਹਾ ਜਿਹਾ ਦੇਖਦਾ ਵੀ ਜੇੇ ਇੱਧਰੋਂ ਟੈਮ ਕੱਢ ਕੇ ਜੇ ਇੱਕ ਡੇਢ ਘੰਟੇ ਤੱਕ ਮੈਂ ਫ੍ਰੀ ਹੋ ਗਿਆ

ਛੇਤੀ ਤਾਂ ਫਿਰ ਐਂ ਥੋੜ੍ਹਾ ਜਿਹਾ ਵੀ ਜਿਵੇਂ ਜੇ ਜੇ ਤੁਸੀਂ ਐਮਰਜੈਂਸੀ ਕਹਿੰਦੇ ਫੇਰ ਉਹ ਐਮਰਜੈਂਸੀ ਦੇ ਜਿਹੜੇ ਉਹ ਚਾਰਜ ਨੇ ਉਹ ਥੋੜ੍ਹੇ ਜਿਹੇ ਵੱਧ ਜਾਂਦੇ ਨੇ ਗੇ ਹਾਂ ਉਹ ਥੋੜ੍ਹੇ ਅਸੀਂ ਪੈਸੇ ਵੱਧ ਲੈਂਦੇ ਫਿਰ ਜੇ ਕੋਈ ਮਤਲਬ ਸਾਨੂੰ ਐਮਰਜੈਂਸੀ ਬੁਲਾ ਲੈਂਦਾ ਜੀ ਕਿਉਂਕਿ ਅਸੀਂ ਵੀ ਕੰਮ ਛੱਡ ਕੇ ਆਉਣਾ ਹੁੰਦਾ ਜੀ ਐਡੀ ਦੂਰੋਂ ਊਂ ਤਾਂ ਵੈਸੇ ਤਾਂ ਅਸੀਂ ਨੋਰਮਲ ਜੇ ਅਸੀਂ ਜਾਣਾ ਹੋਵੇ ਫੇਰ ਤਾਂ ਅਸੀਂ ਸੱਤ ਸੌ ਰੁਪਿਆ ਲੈਂਦੇ ਹਾਂ ਜੀ ਜੇ ਕੋਈ ਬੰਦਾ ਸਾਨੂੰ ਐਮਰਜੈਂਸੀ ਬੁਲਾਵੇ ਫੇਰ ਅਸੀਂ ਬਾਰ੍ਹਾਂ ਬਾਰ੍ਹਾਂ ਸੌ ਰੁਪਿਆ ਲੈਂਦੇ ਹਾਂ ਤੁਸੀਂ ਦੇਖ ਲਉ ਜੇ ਤੁਸੀਂ ਵੀ ਹੁਣ ਦੇਖੋ ਫਿਰ ਖੁਦ ਅਸੀਂ ਵੀ ਹੁਣ ਮੈਂ ਵੀ ਦੂਰੋਂ ਮੈਂ ਵੀ ਤੇਲ ਮਚਾ ਕੇ ਹਾਂਜੀ ਅਸੀਂ ਤੇਲ ਮਚਾ ਕੇ ਆਵਾਂਗੇ ਐਡੀ ਦੂਰੋਂ ਜੀ ਅਸੀਂ ਤਾਂ ਕੰਮ ਵੀ ਛੱਡ ਕੇ ਆਵਾਂਗੇ ਤੁਹਾਨੂੰ ਐਂ ਹੁੰਦਾ ਵੀ ਚਲ ਜਿਵੇਂ ਐਮਰਜੈਂਸੀ ਕੌਲ ਆ ਗਈ ਚਲੋ ਤੁਸੀਂ ਫੇਰ ਹਜ਼ਾ ਹਜ਼ਾ ਹਜ਼ਾ ਕ ਹਜ਼ਾ ਹਜ਼ਾਰ ਰੁਪਿਆ ਚਲ ਤੁਸੀਂ ਦੇ ਦਿਓ ਅਸੀਂ ਆਂ ਜਾਂਗੇ ਫਿਰ ਕੋਈ ਨਹੀਂ ਤੁਸੀਂ ਕਿੰਨੇ ਕਹਿੰਦੇ ਹੋ ਚਲੋ ਫਿਰ ਕੋਈ ਗੱਲ ਨਹੀਂ ਫਿਰ ਅਸੀਂ ਹਾਂ ਚਲੋ ਅਸੀਂ ਅਸੀਂ ਹੁਣ ਦਸ ਮਿੰਟ ਤੱਕ ਆਉਂਦੇ ਹਾਂ ਫਿਰ ਠੀਕ ਹੈ ਠੀਕ ਹੈ ਓਕੇ